ਜਾਨਵਰਾਂ ਨੂੰ ਚਰਾਉਣ ਲਈ ਹਰੇ ਵਿਹੜੇ ਉਪਲਬਧ ਹਨ ਜਾਨਵਰਾਂ ਦੇ ਉੱਪਰ ਅਸੀਂ ਬਹੁਤ ਹੀ ਬੁਰਾ ਪ੍ਰਭਾਵ ਦੇਖਿਆ ਹੈ ਜੋ ਕਿ ਵਾਤਾਵਰਨ ਵਿੱਚ ਤਬਦੀਲੀਆਂ ਦੇ ਕਾਰਨ ਆ ਰਿਹਾ ਹੈ ਜਿਵੇਂ ਕਿ ਉਹਨਾਂ ਵਿੱਚ ਆਉਂਦਾ ਹੈ ਖਰਾਬ ਜਲਵਾਯੂ ਖਰਾਬ ਮੌਸਮ ਪਲਾਸਟਿਕ ਦੀ ਵਰਤੋਂ ਪਾਣੀ ਦੀ ਕਮੀ ਆਦਿ ਇਹਨਾਂ ਵਿੱਚ ਅਸੀਂ ਦੇਖਦੇ ਹਾਂ ਕਿ ਜਾਨਵਰਾਂ ਦੀ ਸਿਹਤ ਦੇ ਉੱਪਰ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ ਜਿਵੇਂ ਕਿ ਖਰਾਬ ਮੌਸਮ ਕਾਰਨ ਵੀ ਉਹਨਾਂ ਦੇ ਜੀਵਨ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਅੱਜ ਕੱਲ੍ਹ ਪਲਾਸਟਿਕ ਦੀ ਵਰਤੋਂ ਕਰਨ ਨਾਲ ਉਹਨਾਂ ਦਾ ਪੇਟ ਵੀ ਖਰਾਬ ਹੋ ਜਾਂਦਾ ਹੈ ਜਿਸ ਕਾਰਨ ਉਹ ਦੁੱਧ ਨਹੀਂ ਦੇ ਪਾਉਂਦੀਆਂ ਉਸ ਦੇ ਵਿੱਚ ਹੀ ਪਾਣੀ ਦੀ ਕਮੀ ਵੀ ਹੈ ਅਤੇ ਜੋ ਉਹਨਾਂ ਨੂੰ ਚਾਰਾ ਖਵਾਇਆ ਜਾਂਦਾ ਹੈ ਉਹ ਵੀ ਮਿਲਾਵਟੀ ਹੀ ਹੁੰਦਾ ਹੈ ਜਿਸ ਕਾਰਨ ਉਹ ਦੁੱਧ ਵੀ ਸਹੀ ਤਰ੍ਹਾਂ ਨਹੀਂ ਦੇ ਪਾਉਂਦੀਆਂ ਹਨ ਅਤੇ ਉਹ ਜਦੋਂ ਉਹ ਬੱਚਾ ਪੈਦਾ ਕਰਦੀਆਂ ਹਨ ਤਾਂ ਉਹਨਾਂ ਨੂੰ ਵੀ ਬਹੁਤ ਸਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਦੇ ਜੀਵਨ ਦੇ ਵਿੱਚ ਜੋ ਕਿ ਅਸੀਂ ਮਾਨਵ ਜੀਵਨ ਦੇ ਵਿੱਚ ਚਾਹੁੰਦੇ ਹਾਂ ਕਿ ਸਾਨੂੰ ਇੱਕ ਜੋ ਆਪਾਂ ਪੋਸ਼ਣ ਮਿਲਦਾ ਹੈ ਉਹ ਦੁੱਧ ਤੋਂ ਹੀ ਮਿਲਦਾ ਹੈ ਅਗਰ ਸਾਨੂੰ ਉਹ ਦੁੱਧ ਹੀ ਸਹੀ ਨਹੀਂ ਮਿਲੇਗਾ ਜੋ ਕਿ ਸਾਨੂੰ ਜਾਨਵਰਾਂ ਕੋਲੋਂ ਪਸ਼ੂਆਂ ਕੋਲੋਂ ਮਿਲਦਾ ਹੈ ਅਗਰ ਉਹੀ ਨਹੀਂ ਸਹੀ ਮਿਲੇਗਾ ਤਾਂ ਸਾਡੇ ਮਾਨਵ ਜੀਵਨ ਦੀ ਸਿਹਤ 'ਤੇ ਵੀ ਬਹੁਤ ਬੁਰਾ ਪ੍ਰਭਾਵ ਇਸ ਦਾ ਪਏਗਾ ਜੋ ਕਿ ਅਸੀਂ ਚਾਹੁੰਦੇ ਹਾਂ ਕਿ ਵਧੀਆ ਜਲਵਾਯੂ ਹੋਵੇ ਪਲਾਸਟਿਕ ਦੀ ਕ ਵਰਤੋਂ ਬਹੁਤ ਘੱਟ ਕੀਤੀ ਜਾਵੇ ਜਿਸ ਕਾਰਨ ਜਾਨਵਰ ਬਿਲਕੁਲ ਠੀਕ ਰਹਿਣ